ਸਾਡੇ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮਹੱਤਤਾ ਹੈ ਅਤੇ ਸਮੇਂ ਦੇ ਨਾਲ ਨਾਲ ਇਹ ਪੰਜਾਬ ਦੇ ਤਿਉਹਾਰਾਂ

ਜਿਵੇਂ ਕਿ ਵਿਸਾਖੀ ਲੋਹੜੀ ਜਾਂ ਕੋਈ ਹੋਰ ਖਾਸ ਤਿਉਹਾਰ ਦਾ ਇਹ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਇਹ ਪੰਜਾਬ ਦਾ ਇੱਕ ਖਾਸ ਨਾਚ ਮੰਨਿਆ ਗਿਆ ਹੈ ਭੰਗੜਾ ਬਹੁਤ ਹੀ ਤਰ੍ਹਾਂ ਦੇ ਵਿਸ਼ੇਸ਼ ਅਵਸਰਾਂ 'ਤੇ ਪਾਇਆ ਜਾਂਦਾ ਹੈ ਜਿਵੇਂ ਕਿ ਵਿਸਾਖੀ ਵਿਆਹ ਦਾ ਤਿਉਹਾਰ ਕਾਲਜਾਂ 'ਚ ਫੰਕਸ਼ਨਾਂ ਦੌਰਾਨ ਭੰਗੜਾ ਜਿਵੇਂ ਕਿ ਸਕੂਲਾਂ 'ਚ ਫੰਕਸ਼ਨਾਂ ਦੌਰਾਨ ਭੰਗੜਾ ਇਸ ਦੀ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਇਹ ਇੱਕ ਪੰਜਾਬ ਦਾ ਪ੍ਰਸਿੱਧ ਨਾਚ ਹੈ ਪ੍ਰਸਿੱਧ ਲੋਕ ਨਾਚ ਹੈ